ਬਾਈਕਿੰਗ ਦੁਆਰਾ ਸਥਾਨਕ ਅਰਥ ਵਿਵਸਥਾ ਨੂੰ ਉਤਸਾਹਿਤ ਕਰਨ ਲਈ ਕਈ ਪ੍ਰਆਸ ਕੀਤੇ ਜਾਂਦੇ ਹਨ ਜਿਸ ਤਰਾਂ ਕਿ ਵੱਖ ਵੱਖ ਬਾਈਕਰਸ ਕਲੱਬ ਦੀ ਸਥਾਪਨਾ ਕੀਤੀ ਗਈ ਹੈ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਵਿੱਚ ਲਗਭਗ ਦੋ ਦੋ ਜਾਂ ਤਿੰਨ ਤਿੰਨ ਬਾਈਕਰਸ ਕਲੱਬ ਸਥਾਪਿਤ ਹਨ ਜਿਹੜੇ ਕਿ ਇਕੱਠਿਆਂ ਹੋ ਕਰ ਕਈ ਲੰਬੇ ਸਫਰਾਂ 'ਤੇ ਜਾਂਦੇ ਹਨ ਅਤੇ ਜਿਹੜੀ ਵੀ ਸ਼ਹਿਰ ਵਿੱਚ ਜਾਂਦੇ ਹਨ ਉੱਥੇ ਦੀ ਅਰਥ ਵਿਵਸਥਾ ਨੂੰ ਪ੍ਰਭਾਵਿਤ ਕਰਦੇ ਹਨ ਬਾਈਕਰਸ ਕਲੱਬ ਹਮੇਸ਼ਾ ਇਕੱਠ ਦਾ ਮੈਸੇਜ ਦਿੰਦੇ ਹਨ ਜਿਸ ਨਾਲ ਆਮ ਵਰਗ ਨੂੰ ਇੱਕ ਵਧੀਆ ਅਤੇ ਸਾਫ ਸੁਥਰਾ ਮਾਹੌਲ ਬਣਾਈ ਰੱਖਣ ਲਈ ਪ੍ਰੇਰਨਾ ਵੀ ਮਿਲਦੀ ਹੈ ਬਾਈਕਰਸ ਕਲੱਬ ਸਥਾਨਕ ਸੈਰ ਸਪਾਟੇ ਨੂੰ ਵੀ ਉਸਾਹਿਤ ਕਰਦੇ ਹਨ ਬਾਈਕਰਸ ਕਲੱਬ ਨੂੰ ਦੇਖਦਿਆਂ ਬਾਕੀ ਲੋਕਾਂ ਵਿੱਚ ਵੀ ਉਤਸ਼ਾਹਿਤਾ ਪੈਦਾ ਹੁੰਦੀ ਹੈ